ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡੀ ਵੈਬਸਾਈਟ ਤੋਂ ਹੇਅਰ ਜੈੱਲ ਔਡਰ ਕੀਤੀ ਸੀ ਪਹਿਲੀ ਗੱਲ ਤਾਂ ਉਹ ਡਿਲੀਵਰੀ ਡੇਟ ਤੋਂ ਬਹੁਤ ਦਿਨਾਂ ਬਾਅਦ ਮੈਨੂੰ ਮਿਲੀ ਉਸ ਤੋਂ ਬਾਅਦ ਜਦੋਂ ਮੈਂ ਉਸਨੂੰ ਓ ਉਸਦਾ ਬੋਕਸ ਓਪਨ ਕੀਤਾ ਉਹਦੀ ਸੀਲ ਖੁੱਲ੍ਹੀ ਹੋਈ ਸੀਗੀ ਤੇ ਜੈੱਲ ਹਾਰਡ ਸੀ ਫਿਰ ਉਸ ਤੋਂ ਬਾਅਦ ਮੈਂ ਉਸਨੂੰ ਲਾਉਣਾ ਸ਼ੁਰੂ ਕੀਤਾ ਆਪਣੇ ਬਾਲਾਂ ਉੱਤੇ ਉਸਦੇ ਥੋੜ੍ਹੇ ਡੈ ਦਿਨਾਂ ਵਿੱਚ ਮੇਰੇ ਬਾਲ਼ ਚਿੱਟੇ ਕਰਤੇ